ਸਾਡੇ ਮੰਨੋਰੰਜਨ ਦੇ ਜਿਹੜੇ ਸਾਧਨ ਆ ਸੈਲਾਨੀਆਂ ਲਈ ਵਿਕਲਪ ਪੰਜਾਬ ਤੇ ਜਾਣ ਵੇਲੇ ਉਹ ਇਹ ਸਕਦੇ ਨੇ ਬਈ ਇੱਕ ਤਾਂ ਸਾਡੇ ਵਿਸਾਖੀ ਬਹੁਤ ਮਸ਼ਹੂਰ ਆ ਵਿਸਾਖੀ ਤੋਂ ਪਹਿਲਾਂ ਲੋਹੜੀ ਬਹੁਤ ਮਸ਼ਹੂਰ ਆ ਵਿਸਾਖੀ ਵਿਸਾਖੀ ਤੋਂ ਬਾਅਦ ਫਿਰ ਦੁਸਹਿਰਾ ਆ ਜਾਂਦਾ ਦਿਵਾਲੀ ਆ ਜਾਂਦਾ ਜੇ ਆ ਜੋ ਕਿ ਦੀਪ ਦੀਵਿਆਂ ਦਾ ਤਿਉਹਾਰ ਮੰਨਿਆ ਜਾਂਦਾ ਉਸਨੂੰ ਉਸਨੂੰ ਬੜੇ ਢੰਗ ਨਾਲ ਮਨਾਉਂਦੇ ਆ ਵਿਸਾਖੀ ਨੂੰ ਇਹ ਹੈ ਵੀ ਜੋ ਕਣਕ ਕਿਸਾਨਾਂ ਨੇ ਬੀਜੀ ਹੁੰਦੀ ਉਹਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਉਹ ਵਿਸਾਖੀ ਨੂੰ ਉਸ ਖੁਸ਼ੀ ਦੇ ਵਿੱਚ ਲਾ ਕੇ ਚਾਦਰੇ ਗੱਭਰੂ ਫਿਰ ਭੰਗੜਾ ਪਾਉਂਦੇ ਹੈ ਗਿੱਧਾ ਪੈਂਦਾ ਅਤੇ ਪੂਰੇ ਧੂਮ ਧਾਮ ਨਾਲ ਮਨਾਇਆ ਜਾਂਦਾ ਦਿਵਾਲੀ ਆ ਇਸ ਤੋਂ ਬਾਅਦ ਦਿਵਾਲੀ ਆ ਜਿਵੇਂ ਦਿਵਾਲੀ ਸਾਡੇ ਭਾਰਤ ਦਾ ਇਕੱਲੇ ਪੰਜਾਬ ਦਾ ਹੀ ਨਹੀਂ ਭਾਰਤ ਦੇ ਹੀ ਪ੍ਰਸਿੱਧ ਤਿਉਹਾਰ ਆ ਸਾਡੇ ਪੰਜਾਬ ਦੇ ਵਿੱਚ ਇਹ ਜਿਵੇਂ ਬੰਦੀ ਛੋੜ ਦਿਵਸ ਦੇ ਨਾਮ ਨਾਲ ਵੀ ਜਾਨ ਜਾਣਿਆ ਜਾਂਦਾ ਬੰਦੀ ਛੋੜ ਦਿਵਸ ਦੇ ਉਪਰੰਤ ਦੀਵਿਆ ਨਾਲ ਚਾਨਣ ਕੀਤਾ ਗਿਆ ਸੀਗਾ ਅਤੇ ਇਹ ਸਾਡੇ ਵਿਕਲਪ ਹਨ ਸੈਲਾਨੀਆਂ ਲਈ ਮੰਨੋਰੰਜਨ ਦੇ ਜੋ ਕਿ ਹਰ ਇੱਕ ਮਾਣ ਕਰਕੇ ਖੁਸ਼ ਹੁੰਦਾ